ਪਿਆਰੇ ਮਿੱਤਰ ਰੋਹਨ ਮੈਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਤੁਹਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ ਇਹ ਬੜੀ ਦੁੱਖ ਦੀ ਘਟਨਾ ਹੈ ਇਸ ਸਮੇਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦਿਲਾਸਾ ਦੇਣ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਹੈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਮੈਨੂੰ ਪਤਾ ਹੈ ਕਿ ਪਿਤਾ ਦੀ ਜਗ੍ਹਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਲੈ ਸਕਦਾ ਪਰ ਫੇਰ ਵੀ ਤੁਹਾਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਹੌਸਲਾ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿਤਾ ਜੀ ਦੀ ਮੌਤ ਦਾ ਰਜਿਸਟਰੇਸ਼ਨ ਰਜਿਸਟਰੇਸ਼ਨ ਦਫਤਰ ਦੇ ਵਿੱਚ ਜਾ ਕੇ ਕਰਵਾਓ ਇਸ ਦੇ ਲਈ ਤੁਹਾਨੂੰ ਕਈ ਤਰ੍ਹਾਂ ਦੀਆਂ ਦਸਤਾਵੇਜ਼ ਉੱਥੇ ਜਮਾਂ ਕਰਵਾਉਣੇ ਪੈਣਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਜਨਮ ਦੇ ਸਰਟੀਫਿਕੇਟ ਦੀ ਕਾਪੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਦਾ ਸਮਾਂ ਤੇ ਦਿਨ ਉਸ ਦੇ ਲਈ ਜੋ ਐਫੀਡੈਫਟ ਹੈ ਉਸ ਦੀ ਕਾਪੀ ਸਥਾ ਅਲੱਗ ਅਲੱਗ ਤਰ੍ਹਾਂ ਦੀਆਂ ਜੋ ਸਟੈਂਪਸ ਕੋਰਟ ਦੀਆਂ ਲੱਗਦੀਆਂ ਹਨ ਉਹਨਾਂ ਦੀ ਫੀਸ ਤੇ ਇਸ ਤੋਂ ਇਲਾਵਾ ਰਾਸ਼ਨ ਕਾਰਡ ਜਿਸ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ ਇਹ ਸਾਰੀਆਂ ਚੀਜ਼ਾਂ ਉੱਥੇ ਜਮਾ ਕਰਵਾਓ ਤੁਹਾਨੂੰ ਇੱਕੀ ਦਿਨ ਦੇ ਵਿੱਚ ਵਿੱਚ ਜਨਮ ਦਾ ਸਰਟੀਫਿਕੇਟ ਜੋ ਹੈ ਉਹ ਪ੍ਰਾਪਤ ਹੋ ਜਾਵੇਗਾ ਸਾਡੇ ਲਈ ਇੱਕ ਜਰੂਰੀ ਕਦਮ ਹੁੰਦਾ ਹੈ ਕਿਉਂਕਿ ਜੋ ਵੀ ਤੁਹਾਡੇ ਪਿਤਾ ਜੀ ਨੇ ਤੁਹਾਡੇ ਲਈ ਸੇਵਿੰਗਸ ਕੀਤੀਆਂ ਨੇ ਉਹਨਾਂ ਦੀ ਪ੍ਰਤੀ ਪੂਰਤੀ ਲਈ ਜਨਮ ਸਰਟੀਫਿਕੇਟ ਦੇ ਨਾਲ ਮੌਤ ਸਰਟੀਫਿਕੇਟ ਦਾ ਹੋਣਾ ਬਹੁਤ ਜਰੂਰੀ ਹੈ ਮੌਤ ਸਰਟੀਫਿਕੇਟ ਹੋਣ ਤੋਂ ਬਾਅਦ ਉਹਨਾਂ ਦੁਆਰਾ ਕਰਵਾਏ ਹੋਏ ਬੀਮੇ ਤੇ ਹੋਰ ਵੀ ਜੋ ਵੀ ਕਾਨੂੰਨੀ ਮਾਮਲੇ ਹਨ ਉਹਨਾ ਦੇ ਲਈ ਜਿਹੜੀ ਪ੍ਰਤੀ ਪੂਰਤੀ ਹੈ ਉਸਦੇ ਵਿੱਚ ਮੌਤ ਸਰਟੀਫਿਕੇਟ ਹਮੇਸ਼ਾ ਲੱਗਦਾ ਹੈ ਮੈਨੂੰ ਪਤਾ ਹੈ ਕਿ ਇਸ ਸਮੇਂ ਅਜਿਹੀਆਂ ਗੱਲਾਂ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਫਿਰ ਵੀ ਤੁਹਾਨੂੰ ਇਹੀ ਕਹਾਂਗਾ ਕੀ ਤੁਸੀਂ ਹੌਸਲਾ ਨਾ ਛੱਡੋ ਤੇ ਅੱਗੇ ਵਧ ਕੇ ਆਪਣੇ ਪਿਤਾ ਦੀਆਂ ਜਿੰਮੇਵਾਰੀਆਂ ਨੂੰ ਪੂਰਾ ਕਰੋ ਉਹਨਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰੋ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਧਿਆਨ ਰੱਖੋ ਉਹਨਾਂ ਦੇ ਸਾਰੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਾਰੀ ਜਿੰਮੇਵਾਰੀ ਹੁਣ ਤੁਹਾਡੇ ਉੱਪਰ ਹੈ ਇਸ ਲਈ ਕਦੇ ਵੀ ਹੌਸਲਾ ਨਾ ਹਾਰਿਓ ਤੇ ਜੇ ਮੇਰੇ ਯੋਗ ਕੋਈ ਵੀ ਕੰਮ ਹੋਵੇ ਤਾਂ ਦੱਸਿਓ